ਫੁਲਕਾਰੀ ਇੱਕ ਤਰਹਾਂ ਦੀ ਕੜਾਈ ਹੁੰਦੀ ਹੈ ਜੋ ਚੁੰਨੀਆਂ ਦੁਪੱਟਿਆ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ ਫੁਲਕਾਰੀ ਸ਼ਬਦ ਫੁੱਲ ਅਤੇ ਕਾਰੀ ਤੋਂ ਬਣਿਆ ਹੈ ਇਸ ਦਾ ਮਤਲਬ ਫੁੱਲਾਂ ਦੀ ਕਾਰੀਗਰੀ ਇਹਨਾਂ ਦਾ ਜੋ ਪੰਜਾਬੀ ਕੁੜੀਆਂ ਦੁਆਰਾ ਵਿਆਹ ਅਤੇ ਤਿਹਾਰਾਂ ਦੇ ਮੌਕੇ ਉੱਤੇ ਕੀਤਾ ਜਾਂਦਾ ਹੈ ਸ਼ਗਨਾਂ ਦੇ ਮੌਕਿਆਂ ਤੇ ਲੋਕ ਫੁਲਲਕਾਰੀਆਂ ਦੀ ਵਰਤਿਆ ਕਰਦੇ ਸਨ ਲੋਕ ਦਾਜ ਵਿੱਚ ਧੀਆਂ ਦੀ ਨੂੰ ਵੀ ਫੁਲਕਾਰੀਆਂ ਦੇ ਬਾਗ ਦਿੰਦੇ ਹਨ ਇਨਾਂ ਇਹ ਫੁਲਕਾਰੀਆਂ ਨਾਨੀਆਂ ਦਾਦੀਆਂ ਤੋਂ ਅੱਗੇ ਪੀੜੀ ਦਰ ਪੀੜੀ ਚਲਦੀਆਂ ਰਹਿੰਦੀਆਂ ਸਨ